ਪੰਜਾਬ ਵਿੱਚ ਕਈ ਐਸੇ ਸਥਾਨ ਹਨ ਜਿੱਥੇ ਮੈਂ ਆਪਣੇ ਪਰਿਵਾਰ ਨਾਲ ਜਾਂਦੀ ਹਾਂ ਅਤੇ ਮੈਨੂੰ ਉੱਥੇ ਜਾਣਾ ਬਹੁਤ ਪਸੰਦ ਹੈ ਅਤੇ ਵਿਹਲੇ ਵਕਤ ਜਾਂ ਛੁੱਟੀਆਂ ਮੈਂ ਉੱਥੇ ਹੀ ਮਨਾਉਣ ਜਾਂਦੀ ਹਾਂ ਪੰਜਾਬ ਵਿੱਚ ਕਈ ਸਾਰੇ ਘੁੰਮਣ ਦੀਆਂ ਥਾਵਾਂ ਹਨ ਜਿਵੇਂ ਕਿ ਹਰਿਮੰਦਰ ਸਾਹਿਬ ਜਲ੍ਹਿਆਂਵਾਲਾ ਬਾਗ ਫਿਰ ਹੋਰ ਵੀ ਕਈ ਸਾਰੇ ਗੁਰਦੁਆਰੇ ਅਤੇ ਮੰਦਿਰ ਹਨ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਹਰਿਮੰਦਰ ਸਾਹਿਬ ਜਾਣ ਦਾ ਆਉਂਦਾ ਹੈ ਕਿਉਂਕਿ ਹਰਿਮੰਦਰ ਸਾਹਿਬ ਮੈਨੂੰ ਇੱਕ ਅਲੱਗ ਹੀ ਸਕੂਨ ਮਿਲਦਾ ਹੈ ਅਤੇ ਇੱਥੇ ਇਹ ਸਾਡੇ ਗੁਰੂਆਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਮੈਨੂੰ ਉਹਨਾਂ ਦੀ ਇਹ ਉਨ ਹਰਿਮੰਦਰ ਸਾਹਿਬ ਦੇਖ ਕੇ ਮੈਨੂੰ ਉਹਨਾਂ ਦੀ ਯਾਦ ਆਉਂਦੀ ਹੈ ਹਰਿਮੰਦਰ ਸਾਹਿਬ ਇੱਕ ਅਲੱਗ ਹੀ ਸਕੂਨ ਮਿਲਦਾ ਹੈ ਅਤੇ ਇਹ ਸਾਡੇ ਇਤਿਹਾਸ ਨਾਲ ਜੁੜਿਆ ਹੁੰਦਾ ਹੈ ਜੋ ਕਿ ਸਭ ਨੂੰ ਦੇਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹਦੇ ਨਾਲ ਹੀ ਜਲ੍ਹਿਆਂਵਾਲਾ ਬਾਗ ਹੈ ਜਲ੍ਹਿਆਂਵਾਲਾ ਬਾਗ ਹੈ ਜਿੱਥੇ ਕਈ ਕਈ ਬੰਦਿਆਂ ਨੂੰ ਆਜ਼ਾਦੀ ਦੇ ਸਮੇਂ ਮਾਰਿਆ ਗਿਆ ਸੀ ਅਤੇ ਸਾਡਾ ਇਤਿਹਾਸ ਜਾ ਦ੍ਰਿਸ਼ ਸਾਡਾ ਇਤਿਹਾਸ ਦਾ ਦ੍ਰਿਸ਼ ਪਤਾ ਲੱਗਦਾ ਹੈ ਇਸ ਕਰਕੇ ਮੈਨੂੰ ਹਰਿਮੰਦਰ ਸਾਹਿਬ ਜਾਣਾ ਬਹੁਤ ਪਸੰਦ ਹੈ ਕਿਉਂਕਿ ਇਹ ਸਾਡੇ ਗੁਰੂਆਂ ਦੇ ਨਾਲ ਜੁੜਿਆ ਹੋਇਆ ਹੈ ਧੰਨਵਾਦ